ਮੋਹਾਲੀ ਜ਼ਿਲ੍ਹੇ ਦੇ ਜ਼ਿਆਦਾਤਰ ਲੋਕ ਔਫਿਸ ਵਰਕ ਨੂੰ ਤਰਜੀਹ ਦਿੰਦੇ ਹਨ ਉੱਥੇ ਮਰਦਾਂ ਦੇ ਨਾਲ ਔਰਤਾਂ ਵੀ ਕੰਮਾਂ ਦੇ ਵਿੱਚ ਪਹਿਲ ਦੇ ਰਹੀਆਂ ਹਨ ਜਿੱਥੇ ਪਹਿਲਾਂ ਮਰਦ ਹੀ ਨੌਕਰੀ ਕਰਦੇ ਸਨ ਆਪਣਾ ਮਰਦ ਪ੍ਰਧਾਨ ਸਮਾਜ ਸੀ ਅਤੇ ਮੋਹਾਲੀ ਜ਼ਿਲ੍ਹਾ ਇੱਕ ਵਿਕਸਿਤ ਜ਼ਿਲ੍ਹਾ ਹੋਣ ਦੇ ਨਾਲ ਨਾਲ ਉੱਥੇ ਔਰਤਾਂ ਵੀ ਇਸ ਕੰਮਾਂ ਦੇ ਵਿੱਚ ਪਹਿਲ ਦੇ ਰਹੀਆਂ ਨੇ ਅਤੇ ਇਹ ਕਿੱਤੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਆਰਥਿਕ ਜੀਵਨ ਨੂੰ ਉਹਨਾਂ ਦੇ ਜਿਹੜੇ ਕੰਮ ਹੁੰਦੇ ਨੇ ਜਿਵੇਂ ਕੋਲਿੰਗ ਸੈਂਟਰ ਦੇ ਵਿੱਚ ਜੋਬ ਲੱਗਣਾ ਟੀਚਿੰਗ ਕਿਸੇ ਨੂੰ ਟੀਚ ਕਰਨਾ ਕਿਸੇ ਸਟੂਡੈਂਟਸ ਨੂੰ ਟਿਊਸ਼ਨਸ ਪੜ੍ਹਾਉਣਾ ਜਾਂ ਇੰਜੀਨੀਅਰਿੰਗ ਦੇ ਸਟੂਡੈਂਟ ਹੈ ਨਾ ਅਤੇ ਅੱਗੇ ਆਪਾਂ ਨੂੰ ਇਹਨਾਂ ਦੇ ਨਾਲ ਰਿਲੇਟਡ ਹੀ ਪ੍ਰੋਫੈਸ਼ਨਲ ਕ ਕਰਦੇ ਇਹੀ ਪ੍ਰੋਫੈਸ਼ਨ ਦੇ ਵਿਅਕਤੀ ਮਿਲ ਜਾਂਦੇ ਹਨ ਜੋ ਇਸੇ ਪ੍ਰੋਫੈਸ਼ਨ ਦੇ ਵਿੱਚ ਜੋਬ ਕਰਦੇ ਹਨ